ਮੈਨੂੰ ਨੈਚਰਲ ਸੀਨ ਬਹੁਤ ਪਸੰਦ ਹਨ ਇਸ ਕਰਕੇ ਮੈਂ ਨੇਚਰ ਦੀਆਂ ਫੋਟੋਆਂ ਖਿੱਚਦਾ ਹਾਂ ਪਹਾੜੀ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਸੰਘਣੇ ਦਰੱਖਤਾਂ ਦੇ ਦ੍ਰਿਸ਼ ਪਹਾੜਾਂ ਦੇ ਦ੍ਰਿਸ਼ ਬਰਫ ਦੇ ਦ੍ਰਿਸ਼ ਅਜਿਹੀਆਂ ਤਸਵੀਰਾਂ ਮੈਨੂੰ ਚੰਗੀਆਂ ਲੱਗਦੀਆਂ ਹਨ ਇਹਦੇ ਨਾਲ ਨਾਲ ਅਜਿਹੇ ਇਲਾਕਿਆਂ ਵਿੱਚ ਫੈਮਿਲੀ ਫੋਟੋਆਂ ਖਿੱਚਣੀਆਂ ਵੀ ਮੈਨੂੰ ਚੰਗੀਆਂ ਲੱਗਦੀਆਂ ਹਨ ਇਹਦੇ ਪਿੱਛੇ ਕਰਨ ਇਹੋ ਹੀ ਹੈ ਕਿ ਮੈਨੂੰ ਅਜਿਹੀਆਂ ਤਸਵੀਰਾਂ ਪਸੰਦ ਹਨ ਸਕੂਨ ਦਿੰਦਿਆਂ ਹਨ ਇਸੇ ਲਈ ਮੈਂ ਅਜਿਹੀਆਂ ਤਸਵੀਰਾਂ ਨੂੰ ਖਿੱਚਣਾ ਪਸੰਦ ਕਰਦਾ ਹਾਂ ਇਸ ਤੋਂ ਇਲਾਵਾ ਮੈਂ ਪਬਲਿਕ ਪਲੇਸਿਸ ਦੀਆਂ ਤਸਵੀਰਾਂ ਵੀ ਖਿੱਚਣੀਆਂ ਪਸੰਦ ਕਰਦਾ ਹਾਂ ਤਾਂ ਕਿ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਹੈ ਉਸ ਬਾਰੇ ਉਸ ਸਾਰੇ ਦੀ ਤਸਵੀਰ ਆਪਣੇ ਮਨ ਵਿਚ ਬਿਠਾਈ ਜਾ ਸਕੇ ਲੋਕਾਂ ਨੂੰ ਦਿਖਾਈ ਜਾ ਸਕੇ